ਕੁੜੀਆਂ ਦੀ ਅਤੇ ਮੁੰਡਿਆਂ ਦੀ ਵਰਦੀ ਦੀ ਜਿਹੜੀ ਸਿ ਸਿਖਲਾਈ ਹੈ ਇਸ ਦੇ ਵਿੱਚ ਮੈਨੂੰ ਤਾਂ ਜੇ ਇੰਨਾਂ ਜ਼ਿਆਦਾ ਫਰਕ ਕਦੀ ਨਜ਼ਰ ਨਹੀਂ ਆਇਆ ਪਰ ਫਿਰ ਵੀ ਜੇ ਲੱਗਦਾ ਹੈ ਤਾਂ ਹੋ ਸਕਦਾ ਵੀ ਹੋਵੇ ਪਰ ਦੋਨਾਂ ਦੇ ਗੱਤਕੇ ਵਾਸਤੇ ਜੋ ਵਰਦੀ ਹੈ ਉਹ ਸੇਮ ਹੀ ਹੁੰਦੀ ਹੈ ਦੋਨਾਂ ਦੇ ਹੀ ਚੋਲੇ ਪਾਏ ਹੁੰਦੇ ਆ ਦੁਮਾਲਾ ਸਜਾਇਆ ਜਾਂਦਾ ਹੈ ਔਰ ਬੂਟ ਪਾਣੇ ਇਸ ਵਿੱਚ ਬਹੁਤ ਜ਼ਰੂਰੀ ਹੁੰਦੇ ਹੈ ਔਰ ਜੋ ਕੁੜੀਆਂ ਦੀ ਵਰਦੀ ਹੈ ਉਸ ਵਿੱਚ ਪਜਾਮੀ ਪਾਈ ਜਾਂਦੀ ਹੈ ਚੋਲੇ ਦੇ ਨਾਲ ਔਰ ਮੁੰਡਿਆਂ ਦੀ ਵਰਦੀ ਨਾਲ ਚੋਲੇ ਦੇ ਨਾਲ ਲੌਂਗ ਕਛਹਿਰਾ ਪਾਇਆ ਜਾਂਦਾ ਹੈ ਜਿਸ ਜੋ ਕਿ ਇਹਨਾਂ ਨੂੰ ਆਪਣੀ ਸਿਖਲਾਈ ਵਾਸਤੇ ਸੌਖਾ ਲੱਗਦਾ ਹੈ ਉਸ ਵਿੱਚ ਉਹਨਾਂ ਨੂੰ ਇਹ ਸਿੱਖਣਾ ਇਸ ਤੋਂ ਜ਼ਿਆਦਾ ਤਾਂ ਕੋਈ ਸਾਨੂੰ ਫਰਕ ਕਦੀ ਨਜ਼ਰ ਨਹੀਂ ਆਇਆ